ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਮਾਨਵ ਪਠਾਣੀਆ ਹੈ ਮੈਂ ਪਠਾਨਕੋਟ ਦਾ ਰਹਿਣ ਵਾਲਾ ਹਾਂ ਜਿੱਦਾਂ ਕਿ ਇਨਦਾ ਪ੍ਰਸ਼ਨ ਹੈ ਕਿ ਰਾਜ ਦੀਆਂ ਅਧਿਆਤਮਿਕ ਪਰੰਪਰਾਵਾਂ ਦਾ ਅਨੁਭਵ ਕਰਨ ਦੇ ਕੁਝ ਤਰੀਕੇ ਕੀ ਹਨ ਅਗਰ ਮੈਂ ਇਸ ਪ੍ਰਸ਼ਨ ਵਿੱਚੋਂ ਅਧਿਆਤਮਿਕ ਨੂੰ ਵਿਆਖਿਆ ਕਰਨਾ ਚਾਹੁੰਦਾ ਹਾਂ ਉਹ ਮੈਂ ਇਸ ਪ੍ਰਕਾਰ ਕਰਾਂਗਾ ਕਿ ਅਧਿਆਤਮਿਕ ਹੋਣ ਦਾ ਅਰਥ ਹੈ ਕਿ ਮਨੁੱਖ ਆਪਣੇ ਅਨੁਭਵ ਦੇ ਆਧਾਰ 'ਤੇ ਜਾਣਦਾ ਹੈ ਕਿ ਉਹ ਆਪ ਹੀ ਉਸ ਦੀ ਖੁਸ਼ੀ ਦਾ ਸਰੋਤ ਹੈ ਅਧਿਆਤਮਿਕਤਾ ਮਨੁੱਖ ਦੇ ਅੰਦਰੂਨੀ ਜੀਵਨ ਨਾਲ ਜੁੜੀ ਹੋਈ ਹੈ ਅਤੇ ਇਹ ਉਸੀ ਅੰਦਰੂਨੀ ਯਾਤਰਾ 'ਤੇ ਸ਼ੁਰੂ ਹੋ ਜਾਂਦੀ ਹੈ ਜਿੱਦਾਂ ਕਿ ਪਰੰਪਰਾਵਾਂ ਦਾ ਅਨੁਭਵ ਕਰਨ ਦੇ ਕੁਝ ਤਰੀਕੇ ਹਨ ਜਿੱਦਾਂ ਅਗਰ ਮੈਂ ਨਵਰਾਤਰੀ ਦੀ ਗੱਲ ਕਰਦਾ ਹਾਂ ਤਾਂ ਨਵਰਾਤਰੀ ਦੇ ਆਪਾਂ ਨੌ ਵਰਤ ਰੱਖਦੇ ਹਨ ਜਿਸ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜਿੱਦਾਂ ਕਿ ਦੁਰਗਾ ਪੂਜਾ ਦਿਵਾਲੀ ਨੂੰ ਆਪਾਂ ਰਾਤੀ ਦੀਵੇ ਜਲਾਉਂਦੇ ਹਨ ਦੀਵੇ ਜਲਾਉਣ ਦਾ ਕਾਰਨ ਇਹ ਹੈ ਉਸ ਦਿਨ ਰਾਮ ਭਗਵਾਨ ਜੀ ਅਯੋਧਿਆ ਵਾਪਸ ਆਏ